ਸਾਡੇ ਸਮਾਜ ਵਿੱਚ ਲੋਕ ਡਾਂਸਰਾਂ ਨੂੰ ਬਹੁ ਲੋਕ ਡਾਂਸਰਾਂ ਨੂੰ ਚੰਗਾ ਨਹੀਂ ਸਮਝਦੇ ਉਹ ਬਹੁਤ ਹੀ ਉਹ ਡਾਂਸਰਾਂ 'ਤੇ ਬਹੁਤ ਹੀ ਗੰਦੇ ਕਮੈਂਟ ਕਰਦੇ ਉਹ ਡਾਂਸਰਾਂ ਦੇ ਬਹੁਤ ਹੀ ਘਟੀਆ ਕਮੈਂਟ ਕਰਦੇ ਹਨ ਉਹ ਲੋਕ ਸ਼ਰਾਬ ਪੀ ਕੇ ਉਹਨਾਂ ਨੂੰ ਬਹੁਤਾ ਹੀ ਮਾੜਾ ਚੰਗਾ ਬੋਲਦੇ ਹਨ ਅਤੇ ਉਹਨਾਂ ਨੂੰ ਬਹੁਤ ਹੀ ਅਤੇ ਬਹੁਤ ਹੀ ਉਹਨਾਂ ਬਾਰੇ ਬਹੁਤ ਘਟੀਆ ਸੋਚ ਰੱਖਦੇ ਹਨ ਸ ਉਹਨਾਂ ਲੋਕ ਉਹਨਾਂ ਦੀ ਮਜ਼ਬੂਰੀ ਨਹੀਂ ਸਮਝਦੇ ਕਿ ਉਹ ਕਿਸ ਕਿਸ ਕਰਕੇ ਇਹ ਕੰਮ ਇਹ ਡਾਂਸ ਰਹੇ ਹਨ ਕਈ ਕੁੜੀਆਂ ਦੀ ਬਹੁਤ ਹੀ ਬਹੁਤ ਜ਼ਿਆਦਾ ਮਜ਼ਬੂਰੀ ਹੁੰਦੀ ਹੈ ਜਾਂ ਉਹਨਾਂ ਦੀ ਜਾਂ ਉਹਨਾਂ ਦੇ ਘਰ ਦੀ ਕਿਸੇ ਮੈਂਬਰ ਦੀ ਤਬੀਅਤ ਖਰਾਬ ਹੁੰਦੀ ਹੈ ਜਾਂ ਉਹਨਾਂ ਦੀ ਕੋਈ ਜ਼ਿਆਦਾ ਹੀ ਮਜ਼ਬੂਰੀ ਹੁੰਦੀ ਹੈ ਜਿਸ ਕਰਕੇ ਉਹ ਇਹ ਡਾਂਸ ਕਰਦੀਆਂ ਹਨ ਲੋਕਾਂ ਨੂੰ ਲੋਕ ਨਹੀਂ ਸਮਝਦੇ ਇਸ ਲੋਕ ਇਸ ਗੱਲਾਂ ਨੂੰ ਨਹੀਂ ਸਮਝਦੇ ਲੋਕ ਉਹਨਾਂ ਦਾ ਬਹੁਤ ਮਜ਼ਾਕ ਬਣਾਉਂਦੇ ਹਨ ਜਿਸ ਕਰਕੇ ਡਾਂਸਰਾਂ ਨੂੰ ਜਿਸ ਕਰਕੇ ਉਹ ਕੁੜੀਆਂ ਨੂੰ ਲੋਕ ਜਿਹਨਾਂ ਦਾ ਮਜ਼ਾਕ ਬਣਾ ਰਹੇ ਹਨ ਉਹਨਾਂ ਨੂੰ ਬਹੁਤ ਹੀ ਮਤਲਬ ਕਿ ਬੁਰਾ ਲੱਗਦਾ ਹੈ ਸਾਨੂੰ ਇਸ ਕਰਕੇ ਉਹ ਲੋਕ ਇਸ ਕਰਕੇ ਉਹ ਬਹੁਤ ਹੀ ਬਹੁਤ ਹੀ ਉਦਾਸ ਹੋ ਜਾਂਦੇ ਹਨ